ਹਾਂ ਅਸੀਂ ਇਸ ਨੂੰ ਲਗਭਗ ਹਰ ਰੋਜ਼ ਤਿਆਰ ਕੀਤਾ ਜਾਂਦਾ ਹੈ ਇਹ ਅਜਵਾਇਣ ਦੀ ਰੋਟੀ ਇਹ ਹੁੰਦੀ ਹੈ ਇਸ ਨੂੰ ਕੁਰਕਰੇ ਦੀ ਤਰ੍ਹਾਂ ਪਕਾਇਆ ਜਾਂਦਾ ਹੈ ਇਸ ਵਿੱਚ ਅਸੀਂ ਬਹੁਤ ਸਾਰੇ ਮਸਾਲੇ ਪਾ ਸਕਦੇ ਹਾਂ ਜਿਵੇਂ ਅਜਵਾਇਣ ਕਾਲੀ ਮੈਂ ਪੀਸੀ ਹੋਈ ਕਾਲੀ ਮਿਰਚ ਮਸਾਲੇ ਗਰਮ ਮਸਾਲੇ ਆਦਿ ਇਸ ਨੂੰ ਅਸੀਂ ਹਰ ਰੋਜ਼ ਘਰੇ ਤਿਆਰ ਕਰ ਸਕਦੇ ਹਾਂ ਜਿਵੇਂ ਇਨਸਤੇਪ ਬਣਾਏ ਹੋਏ ਪਕਵਾਨ ਹਨ ਆਲੂ ਟਿੱਕੀ ਪਾਪੜ ਸਮੋਸਾ ਗੁਜੀਆ ਭਰਮੇ ਬੈਂਗਣ ਪੈਟੀਜ਼ ਚਾਵਲ ਖੀਰ ਪੁਲਾਬ ਆਲੂ ਪਰਾਂਠਾ ਆਦਿ ਅਸੀਂ ਇਸਨੂੰ ਹਰ ਰੋਜ਼ ਬਣਾ ਸਕਦੇ ਹਾਂ ਇਹ ਇੱਕ ਘਰੇਲੂ ਬਣਤਰ ਹੁੰਦੀ ਹੈ ਇਹ ਅਸੀਂ ਹਰ ਰੋਜ਼ ਤਿਆਰ ਕਰ ਸਕਦੇ ਹਾਂ